ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਬੋਲ ਫ਼ਾਰਮੈਸੀ ਦਾ ਮਤਲਬ ਮੈਨੇਜਰ ਰਵੀ ਗੱਲ ਕਰ ਰਿਹਾ ਹਾਂਜੀ ਮੈਂ ਤੁਹਾਡੀ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਹਾਂਜੀ ਬਿਲਕੁਲ ਆਪਣੇ ਨਾ ਏਰੀਏ 'ਚ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਏਰੀਆ ਆਪਣਾ ਨੀਅਰ ਬਾਏ ਕਿਹੜਾ ਪੈਂਦਾ ਹੈ ਮਤਲਬ ਤੁਸੀਂ ਮੋਹਾਲੀ ਦੇ ਲੌਕਲ ਹੋ ਜਾਂ ਕਿਤੇ ਬਾਹਰ ਦੇ ਹੋ ਚੰਡੀਗੜ੍ਹ ਪੈਂਦਾ ਤੁਹਾਨੂੰ ਮੋਹਾਲੀ ਲੌਕਲ ਦਾ ਫਿਰ ਇਹ ਹੈ ਕਿ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਆਪਣਾ ਇੱਕ ਸਿਵਲ ਹੋਸਪਿਟਲ ਉੱਥੇ ਵੀ ਜਿੰਨੇ ਵੀ ਡਾਕਟਰ ਵੈੱਲ ਆਪਣਾ ਕੁਆਲੀਫਾਇਲਡ ਨੇ ਅਤੇ ਆਪਣਾ ਇੰਡਸ ਹੋਸਪਿਟਲ ਪੈਂਦਾ ਉੱਥੇ ਅਪੋਲੋ ਹੋਸਪਿਟਲ ਅਤੇ ਉਨ੍ਹਾਂ 'ਚ ਆਪਣੇ ਜਿਹੜੇ ਸਿਵਲ ਹੋਸਪਿਟਲ ਡਾਕਟਰ ਅਮਰ ਬਹਿੰਦੇ ਨੇ ਅਤੇ ਬੜੇ ਹੀ ਮਤਲਬ ਵਧੀਆ ਡਾਕਟਰ ਨੇ ਐਂਡ ਇੱਕ ਆਪਣਾ ਆਈ ਵਾਈ ਹੋਸਪਿਟਲ ਹੈ ਪੰਜ ਫੇਜ਼ 'ਚ ਉਨ੍ਹਾਂ 'ਚ ਵੀ ਬਹੁਤ ਵੈੱਲ ਕੁਆਲੀਫਾਇਲਡ ਡਾਕਟਰ ਨੇ ਉਹ ਤੁਸੀਂ ਉਹਨਾਂ ਕੋਲ ਜਾ ਸਕਦੇ ਹੋ ਹਾਂਜੀ ਮੈਮ ਮੈਂ ਤੁਹਾਨੂੰ ਭੇਜਦਾ ਤੁਹਾਨੂੰ ਮੈਂ ਜੀ ਜੀ ਵੈਲਕਮ ਜੀ ਵੈਲਕਮ